ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਂ ਜੋਤੀ ਦੀ ਮੰਮਾ ਤੁਸੀਂ ਕੌਣ ਅੱਛਾ ਅੱਛਾ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਅੱਛਾ ਹਾਂਜੀ ਹਾਂਜੀ ਮੈਮ ਅੱਛਾ ਅੱਛਾ ਅੱਛਾ ਓਹ ਇਹ ਤਾਂ ਬਹੁਤ ਵਧੀਆ ਗੱਲ ਆ ਅੱਛਾ ਅੱਛਾ ਇਹ ਤਾਂ ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਤੁਹਾਡੀ ਮਿਹਰਬਾਨੀ ਨਾਲ ਹੀ ਹੈ ਸਭ ਕੁਛ ਹਾਂਜੀ ਹਾਂਜੀ ਮੈਮ ਉਹਨੂੰ ਬਚਪਨ ਤੋਂ ਹੀ ਡਾਂਸ ਦਾ ਬਹੁਤ ਸ਼ੌਂਕ ਹੈ ਕੋਈ ਨਾ ਮੈਮ ਉਹਨੂੰ ਮੈਂ ਦੱਸਾਂਗੀ ਅਤੇ ਮੈਮ ਮੈਂ ਤੁਹਾਨੂੰ ਬਾਅਦ ਵਿੱਚ ਕੋਂਟੈਕਟ ਕਰਾਂਗੀ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਮੈਂ ਜਾਣਾ ਸੀ ਧੰਨਵਾਦ ਥੈਂਕ ਯੂ ਮੈਮ